ਬੀਤੇ ਸਮੇਂ ਵਿੱਚ ਸਾਡੇ ਖੇਤਰਾਂ ਵਿੱਚ ਸਿਲਾਈ ਬੁਣਾਈ ਪੈਟਰਨ ਬਹੁਤ ਹੀ ਜ਼ਿਆਦਾ ਯੂਨੀਕ ਸਨ ਸਾਡੇ ਘਰ ਦੀਆਂ ਔਰਤਾਂ ਅਤੇ ਜਨਾਨੀਆਂ ਬਾਹਰ ਬੈਠਿਆਂ ਧੁੱਪ ਸੇਕਦੀਆਂ ਹੋਈਆਂ ਸਿਲਾਈ ਅਤੇ ਬੁਣਾਈ ਕਰਦੀਆਂ ਰਹਿੰਦੀਆਂ ਸਨ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਬਣਾਉਣਾ ਉਨ੍ਹਾਂ ਦਾ ਸ਼ੌਂਕ ਸੀਗਾ ਸਾਡੇ ਅ ਹੁਣ ਸਾਡੇ ਰਿਵਾਜ਼ਾਂ ਵਿੱਚ ਪਹਿਲਾਂ ਕਈ ਕੁੜੀਆਂ ਆਪਣਾ ਸ਼ੁਰੂ ਤੋਂ ਹੀ ਕਢਾਈ ਬੁਣਾਈ ਸਿੱਖਣਾ ਸ਼ੁਰੂ ਕਰ ਦਿੰਦੀਆਂ ਸਨ ਅਤੇ ਆਪਣੇ ਸਵੈਟਰ ਘ ਘਰ ਦੀਆਂ ਚੁੰਨੀਆਂ ਸਲਵਾਰਾਂ ਅਤੇ ਆਪ ਹੀ ਸਿਲਾਈ ਅਤੇ ਬੁਣਾਈ ਕਰਦੀਆਂ ਸਨ ਜੋ ਕਿ ਉਹ ਆਪਣੇ ਦਾਜ ਦੇ ਟਾਈਮ 'ਤੇ ਵੀ ਨਾਲ ਹੀ ਲੈ ਜਾਂਦੀਆਂ ਸਨ ਸਾਡੇ ਹਾਲੇ ਵੀ ਦਾਜ ਦੇ ਟਾਈਮ 'ਤੇ ਸਿਲਾਈ ਬੁਣਾਈ ਕੀਤੀਆਂ ਕਈ ਚੀਜ਼ਾਂ ਵਮ ਦਿੱਤੀਆਂ ਜਾਂਦੀਆਂ ਹਨ ਇੱਥੇ ਪਟਿਆਲਾ ਸਲਵਾਰ ਸੂਟ ਕੁੜਤੇ ਪਜਾਮੇ ਧੋਤੀ ਸਲਵਾਰ ਅਤੇ ਸੂਟ ਅਤੇ ਨੌਰਮਲ ਕੁੜਤੇ ਪਜਾਮੇ ਦਾ ਬਹੁਤ ਹੀ ਰਿਵਾਜ਼ ਹੈ ਜੋ ਕਿ ਅੱਜ ਵੀ ਮੁੰਡੇ ਅਤੇ ਕੁੜੀਆਂ ਵਿੱਚ ਬਹੁਤ ਹੀ ਖ਼ਾਸ ਤੌਰ 'ਤੇ ਪਾਏ ਜਾਂਦੇ ਹਨ ਅਤੇ ਖ਼ਾਸ ਮੌਕਿਆਂ 'ਤੇ ਵੀ ਪਾਏ ਜਾਂਦੇ ਹਨ ਸਾਡੇ ਖੇਤਰ ਵਿੱਚ ਸਿਲਾਈ ਬੁਣਾਈ ਸ਼ੁਰੂ ਤੋਂ ਹੀ ਇੱਕ ਯੂਨੀਕ ਆਰਟ ਰਿਹਾ ਹੈ ਸਾਡੇ ਅੰਮ੍ਰਿਤਸਰ ਵਿੱਚ ਸਿਲਾਈ ਅਤੇ ਬੁਣਾਈ ਵੇਖਣ ਲਈ ਦੂਰੋਂ ਦੂਰੋਂ ਕਲਾਕਾਰ ਵੀ ਆਉਂਦੇ ਹਨ ਅਤੇ ਕਲਾਕਾਰਾਂ ਨੂੰ ਸਿੱਖਣ ਲਈ ਵੀ ਬਹੁਤ ਕੁਛ ਮਿਲਦਾ ਹੈ ਸਾਡੇ ਇੱਥੇ ਤਕਨਿਕਾਰ ਬਹੁਤ ਹੀ ਜ਼ਿਆਦਾ ਯੂਨੀਕ ਸਨ